ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਕੌਰ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਰਾਜ ਸਿਹਤ ਸੰਭਾਲ ਦੇ ਖੇਤਰ ਦੀ ਕੁਛ ਗੱਲਾਂ ਕਰਨਾ ਚਾਹੁੰਦੀ ਹਾਂ ਸਾਡੇ ਰਾਜ ਵਿੱਚ ਸਿਹਤ ਸੰਭਾਲ ਖੇਤਰ ਜਿਵੇਂ ਹੋਸਪੀਟਲ ਖੁੱਲ੍ਹੇ ਹੋਏ ਹਨ ਜਿਨ੍ਹਾਂ ਵਿੱਚ ਕਈ ਹੋਸਪੀਟਲ ਬਣੇ ਹੋਏ ਸਨ ਜਿਨ੍ਹਾਂ ਵਿੱਚ ਕਾਫੀ ਗੰਦੀਆਂ ਸ ਸਮਾਨ ਪਏ ਸੀਗੇ ਇਸ ਲਈ ਹੁਣ ਉਹਨਾਂ ਦਾ ਕੋਈ ਕੋਈ ਐਨਾ ਵਧੀਆ ਢਾਂਚਾ ਨਹੀਂ ਸੀ ਪਰ ਜੋ ਜੋ ਹੁਣ ਹੋਸਪੀਟਲ ਨਵੇਂ ਬਣੇ ਹਨ ਉਹਨਾਂ ਵਿੱਚ ਇਮਾਰਤਾਂ ਬਹੁਤ ਹੀ ਵੱਡੀਆਂ ਅ ਹਨ ਖੁੱਲ੍ਹੀਆਂ ਹਨ ਉਹਨਾਂ ਵਿੱਚ ਕਾਫੀ ਤਰ੍ਹਾਂ ਦਾ ਹਾਂ ਨਵੀਆਂ ਤਕਨੀਕਾਂ ਨਾਲ ਬਣਿਆ ਹੋਇਆ ਹੈ ਜੇਕਰ ਜੇਕਰ ਅਸੀਂ ਹੁਣ ਦੇਖੀਏ ਕਿ ਬਜ਼ੁਰਗ ਜਿਹੜੇ ਆ ਉਹ ਛੋਟੀ ਸੀਟ 'ਤੇ ਨਹੀਂ ਬੈਠ ਸਕਦੇ ਸੀਗੇ ਉਹਨਾਂ ਵਾਸਤੇ ਬੈਠਣ ਵਾਸਤੇ ਸੀਟ ਲਗਵਾਈ ਗਈ ਹੈ ਅਤੇ ਕਈ ਵਾਰੀ ਪਾਣੀ ਦਾ ਨਿਕਾਸ ਪੂ ਪਾਣੀ ਦਾ ਨਿਕਾਸ ਦਾ ਪੂਰਾ ਪ੍ਰਬੰਧ ਹੈ ਇੱਥੇ ਨਵੀਂ ਤਕਨੀਕ ਨਾਲ ਤਕਨੀਕ ਨਾਲ ਮਸ਼ੀਨਾਂ ਹਨ ਜਿਵੇਂ ਉੱਥੇ ਆਪਰੇਸ਼ਨ ਵਾਲੀਆਂ ਮਸ਼ੀਨਾਂ ਵੀ ਕਾਫੀ ਆਧੁਨਿਕ ਹਨ ਅਤੇ ਮਰੀਜ਼ਾਂ ਨੂੰ ਲੈਣ ਵਾਸਤੇ ਐਂਬੂਲੈਂਸ ਵੀ ਲਗਾਈ ਗਏ ਹਨ ਅਤੇ ਵ੍ਹੀਲਚੇਅਰ ਵੀ ਇਸ ਲਈ ਸਾਨੂੰ ਇਸ ਲਈ ਸਾਨੂੰ ਕਈ ਸਹੂਲਤਾਂ ਰਾਜ ਸਭਾ ਤੋਂ ਮਿਲਦੀਆਂ ਹਨ ਅਤੇ ਧੰਨਵਾਦ